ਪਹਿਲਾਂ ਤਾਂ ਇਹ ਤਾਲ ਮੱਠੀ ਮੱਠੀ ਵੱਜਦੀ ਹੈ ਅਤੇ ਭਗੋੜਚੀ ਤਾਲ ਉਤੇ ਪੈਰ ਹਿਲਾਉਂਦੀ ਸਰੀਰ ਨੂੰ ਹਲੂਣਾ ਦਿੰਦੀ ਅਤੇ ਮੋਢੇ ਮਾਰਦੇ ਹੋਏ ਨੱਚਦੇ ਹਨ ਕਦੀ ਮੁੱਠੀ ਜਿਹੀ ਮੀਚ ਪਹਿਲੀ ਉਂਗਲੀ ਖੜ੍ਹੀ ਕਰਕੇ ਬਾਹਾਂ ਖਿਲਾਰ ਕੇ ਝਟਕਾ ਦਿੰਦੇ ਹਨ ਮਸਤੀ ਵਿੱਚ ਨੱਚਦੇ ਨਚਾਰਾਂ ਦੇ ਸਰੀਰ ਦਾ ਅੰਗ ਅੰਗ ਢੋਲ ਦੀ ਤਾਲ ਉੱਤੇ ਹਲੋਰੇ ਲੈਣ ਲੱਗ ਪੈਂਦਾ ਹੈ ਹੌਲੀ ਹੌਲੀ ਢੋਲੀ ਆਪਣੀ ਤਾਲ ਨੂੰ ਤੇਜ਼ ਕਰਦਾ ਹੈ ਅਤੇ ਨਾਲ ਹੀ ਨੱਚਣ ਵਾਲੇ ਆਪਣੀਆਂ ਹਰਕਤਾਂ ਤੇਜ਼ ਕਰੀ ਜਾਂਦੇ ਹਨ ਕੁਝ ਚਿਰ ਪਿੱਛੋਂ ਨੱਚਣ ਵਾਲੇ ਖਲੋ ਜਾਂਦੇ ਹਨ ਕੋਈ ਮੰਚਲਾ ਗੱਭਰੂ ਘੇਰੇ ਦੇ ਵਿੱਚ ਪ੍ਰਵੇਸ਼ ਕਰਕੇ ਇੱਕ ਹੱਥ ਕੰਨ ਉੱਤੇ ਰੱਖ ਕੇ ਅਤੇ ਦੂਜਾ ਹੱਥ ਉੱਚਾ ਚੁੱਕ ਕੇ ਅਨੋਖੇ ਢੰਗ ਨਾਲ ਕੋਈ ਬੋਲੀ ਪਾਉਂਦਾ ਹੈ ਜਦੋਂ ਬੋਲੀ ਮੁੱਕਦੀ ਹੈ ਤਾਂ ਢੋਲੀ ਢੋਲ ਉੱਤੇ ਗਿੜਗਿੜਾ ਮਾਰ ਕੇ ਨਚਾਰਾਂ ਨੂੰ ਸਾਵਧਾਨ ਕਰਦਾ ਹੈ ਅਤੇ ਢੋਲ ਦੇ ਤਾਲ ਉੱਤੇ ਭਗੋੜਚੀ ਫਿਰ ਜੋਸ਼ ਵਿੱਚ ਨੱਚਣਾ ਸ਼ੁਰੂ ਕਰ ਦਿੰਦੇ ਹਨ ਢੋਲੀ ਤਾਲ ਬਦਲਦਾ ਰਹਿੰਦਾ ਹੈ ਅਤੇ ਨਚਾਰ ਤਾਲ ਮੁਤਾਬਿਕ ਨੱਚਦੇ ਰਹਿੰਦੇ ਹਨ ਕਈ ਵਾਰ ਕਈ ਮਨਚਲੇ ਜਵਾਨ ਪਾਲ ਛੱਡ ਕੇ ਘੇਰੇ ਦੇ ਅੰਦਰ ਆ ਜਾਂਦੇ ਹਨ ਅਤੇ ਢੋਲ ਦੇ ਤਾਲ 'ਤੇ ਆਪਣੇ ਸਰੀਰ ਦੀਆਂ ਅਨੋਖੀਆਂ ਹਰਕਤਾਂ ਵਿਖਾ ਕੇ ਵੇਖਣ ਵਾਲਿਆਂ ਅਤੇ ਦੂਸਰੇ ਨੱਚਣ ਵਾਲਿਆਂ ਦੀ ਪ੍ਰਸੰਸਾ ਲੈਂਦੇ ਹਨ ਨੱਚਦੇ ਨੱਚਦੇ ਬਹਿ ਕੇ ਇੱਕ ਟੰਗ ਨੂੰ ਤਾਲ ਨਾਲ ਤਾਲ ਅਨੁਸਾਰ ਝਟਕਾ ਦੇ ਕੇ ਖਿਲਾਰਨਾ ਇਸ ਦੀ ਨਾਚ ਦੇ ਸਭ ਤੋਂ ਔਖੀ ਹਰਕਤ ਹੈ ਜਿਹੜੀ ਗਿਣਵੇਂ ਗੱਭਰੂ ਹੀ ਕਰ ਸਕਦੇ ਹਨ ਕਈ ਵਾਰੀ ਦੇ ਨੌਜਵਾਨ ਘੇਰੇ ਦੇ ਅੰਦਰ ਆਹਮੋ ਸਾਹਮਣੇ ਹੋ ਕੇ ਇੰਝ ਨੱਚਦੇ ਹਨ ਜਿਵੇਂ ਆਪੋ ਵਿੱਚ ਮੁਕਾਬਲਾ ਕਰ ਰਹੇ ਹੋਣ ਅਤੇ ਇਸ ਇਨ੍ਹਾਂ ਸਟੈਪਾਂ ਦੇ ਨਾਲ ਸਰੀਰ ਵਿੱਚ ਇਹ ਸਟੈਪ ਸਰੀਰ ਜੋਰ ਵਿੱਚ ਜ਼ੋਰ ਹੋਣ ਕਾਰਨ ਹੀ ਹੋ ਸਕਦੇ ਹਨ ਅਤੇ ਇਸ ਨਾਲ ਸੁਭਾਅ ਵਿੱਚ ਵੀ ਜੋਸ਼ ਆ ਜਾਂਦਾ ਹੈ